ਪੇਂਡੂ ਅਤੇ ਸ਼ਹਿਰੀ ਅਧਿਆਪਨ ਦੇ ਵਿੱਚ ਬਹੁਤ ਫਰਕ ਆ ਉਹਨਾਂ ਮਤਲਬ ਵੀ ਜਿਹੜੇ ਸ਼ਹਿਰੀ ਅਧਿਆਪਨ ਹੁੰਦੇ ਨੇ ਉਹਨਾਂ ਦਾ ਟੀਚਿੰਗ ਮੈਥਡਸ ਹੁੰਦੇ ਨੇ ਜਿਹੜੇ ਸਕੂਲਸ ਦੇ ਵਿੱਚ ਟੀਚ ਕਰਦੇ ਨੇ ਮਤਲਬ ਸਟਾਫ ਮੈਂਬਰਸ ਹੁੰਦੇ ਨੇ ਜਿਹੜੇ ਉਹ ਇੱਕ ਵਧੀਆ ਤਰੀਕੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਸਮਝਾਉਂਦੇ ਨੇ ਉਹਨਾਂ ਨੂੰ ਵਧੀਆ ਐਕਟੀਵਿਟੀਜ਼ ਦੇ ਨਾਲ ਸਮਝਾਉਂਦੇ ਨੇ ਮਤਲਬ ਇੱਕ ਪ੍ਰੈਕਟੀਕਲ ਵੇ ਦੇ ਨਾਲ ਸਮਝਾਉਂਦੇ ਨੇ ਵੀ ਹਾਂ ਤੁਸੀਂ ਇਸ ਕੰਮ ਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਉਹਨਾਂ ਨੂੰ ਕੁਛ ਯਾਦ ਕਰਵਾਉਣਾ ਏ ਤਾਂ ਉਹਦੇ ਲਈ ਵਧੀਆ ਵਧੀਆ ਐਫਰਟਸ ਲਾਉਂਦੇ ਨੇ ਆਪਣੇ ਬਹੁਤ ਜ਼ਿਆਦਾ ਐਫਰਟਸ ਲਾਉਂਦੇ ਨੇ ਜਿਹਦੇ ਕਰਕੇ ਬੱਚੇ ਨੇ ਜਿਹੜੇ ਉਹ ਵਧੀਆ ਤਰੀਕੇ ਨਾਲ ਸਿੱਖ ਪਾਉਂਦੇ ਨੇਗੇ ਉਹਨਾਂ ਨੂੰ ਇੰਗਲਿਸ਼ ਵੀ ਉਹਨਾਂ ਲਈ ਇੰਨਾਂ ਔਖਾ ਮੁਸ਼ਕਿਲ ਨਹੀਂ ਹੁੰਦਾ ਬੱਚਿਆਂ ਲਈ ਸਿੱਖਣਾ ਕਿਉਂਕਿ ਜਿਹੜੇ ਉੱਥੇ ਦੇ ਸਟਾਫ ਮੈਂਬਰਸ ਹੁੰਦੇ ਨੇਗੇ ਟੀਚਰ ਹੁੰਦੇ ਨੇਗੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਇਫੈਕਟਿਵ ਤਰੀਕੇ ਨਾਲ ਉਹ ਚੀਜ਼ਾਂ ਵਧੀਆ ਤਰੀਕੇ ਨਾਲ ਸੌਖੇ ਤਰੀਕੇ ਨਾਲ ਸਿਖਾ ਦਿੰਦੇ ਨੇ ਅਤੇ ਪੇਂਡੂ ਅਧਿਆਪਨ ਲਈ ਮੇਰਾ ਮਤਲਬ ਪੇਂਡੂ ਟੀਚਿੰਗ ਮੈਥਡਸ ਹੁੰਦੇ ਨੇਗੇ ਜਿਹੜੇ ਉਹਨਾਂ ਦੇ ਵਿੱਚ ਕੀ ਆ ਵੀ ਬੱਚਿਆਂ ਨੂੰ ਸਿਰਫ ਪੜ੍ਹਾ ਤਾ ਸਮਝਾ ਤਾ ਆਹ ਚੀਜ਼ ਮੈਂ ਇਵੇਂ ਹੋਵੇਗਾ ਮਤਲਬ ਜ ਅਲੱਗ ਅਲੱਗ ਆਈਡੀਆਜ ਨਹੀਂ ਦਿੱਤੇ ਜਾਂਦੇ ਹੈਗੇ ਜਿਹਦੇ ਕਰਕੇ ਉਹ ਛੇਤੀ ਸੇ ਸਿੱਖ ਸਕਣ ਮਤਲਬ ਉਹਨਾਂ ਨੂੰ ਸਮਝਾ ਦਿੱਤਾ ਜਾਂਦਾ ਵੀ ਆਸ ਇਸ ਚੀਜ਼ ਨੂੰ ਇਸ ਤਰੀਕੇ ਨਾਲ ਕਰਨਾ ਹੈਗਾ ਉਸ ਤੋਂ ਬਾਅਦ ਬਸ ਉਹਨਾਂ ਦੀ ਰਿਵੀਜ਼ਨ ਕਰਵਾਈ ਜਾਣੀ ਰੱਟਾ ਮਰਵਾਈ ਜਾਂਦੇ ਨੇ ਵੀ ਹਾਂ ਤੁਸੀਂ ਏ ਸਮਝਣਾ ਤਾਂ ਬਹੁਤ ਦੂਰ ਦੀ ਗੱਲ ਆ ਸਮਝਾਉਣਾ ਬਹੁਤ ਦੂਰ ਦੀ ਗੱਲ ਆ ਉੱਥੇ ਤਾਂ ਸਿਰਫ ਰੱਟਾ ਚੱਲਦਾ ਹੈਗਾ ਵੀ ਹਾਂ ਬਲੈਕਬੋਰਡ 'ਤੇ ਆਹ ਚੀਜ਼ ਲਿਖਤੀ ਤੁਸੀਂ ਕੱਲ੍ਹ ਨੂੰ ਇਹਨੂੰ ਰੱਟ ਕੇ ਆਉਣਾ ਹੈਗਾ ਪੇਪਰ ਦੇ ਵਿੱਚ ਵੀ ਆਹੀ ਚੀਜ਼ ਆਉਗੀ ਬਸ ਗੱਲ ਖਤਮ ਜੋ ਸਰਕਾਰੀ ਪੇਂਡੂ ਟੀ ਅਧਿਆਪਨ ਦੇ ਵਿੱਚ ਇਹੀ ਆ ਵੀ ਬੱਚਿਆਂ ਨੂੰ ਪਹਿਲਾਂ ਹੀ ਸਾਰਾ ਕੁਛ ਦੱਸ ਦਿੱਤਾ ਜਾਂਦਾ ਵੀ ਹਾਂ ਇਸ ਤਰੀਕੇ ਨਾਲ ਤੁਹਾਡਾ ਆਹ ਟੈਸਟ ਹੋਵੇਗਾ ਇੰਨੇ ਵਜੇ ਤੁਹਾਡਾ ਆਹ ਟੈਸਟ ਹੋਵੇਗਾ ਏਦੋ ਓਦੋਂ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਤੁਸੀਂ ਆਹ ਸਬਜੈਕਟ ਪੜ੍ਹਨਾ ਏ ਇੰਨੇ ਟਾਈਮ ਇੱਨੇ ਟਾਈਮ ਤੱਕ ਤੁਸੀਂ ਆ ਸਬਜੈਕਟ ਪੜ੍ਹਨਾ ਆ ਉਹ ਤਾਂ ਚਲੋ ਟਾਈਮ ਟੇਬਲ ਤਾਂ ਫਿਕਸ ਹੋਣਾ ਹੀ ਚਾਹੀਦਾ ਹਰ ਇੱਕ ਚੀਜ਼ ਦਾ ਬਟ ਉਹਦਾ ਵੀ ਇੱਕ ਉਹ ਆ ਵੀ ਹਾਂ ਬੱਚੇ ਨੂੰ ਤੁਸੀਂ ਕਿਸ ਤਰੀਕੇ ਨਾਲ ਸਿਖਾਉਣਾ ਆ ਬ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿਖਾਇਆ ਜਾਵੇਗਾ ਤਾਂ ਹੀ ਬੱਚੇ ਅੱਗੇ ਜਾ ਕੇ ਪੜ੍ਹ ਸਕਦੇ ਨੇ ਇਸ ਲਈ ਇਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਅਤੇ ਮੇਰਾ ਇਹੀ ਸੁਝਾਅ ਆ ਜਿਹੜੇ ਪੇਂਡੂ ਅਧਿਆਪਨ ਹੁੰਦੇ ਨੇ ਮਤਲਬ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚੇ ਵੀ ਵਧੀਆ ਭਵਿੱਖ ਬਣਾ ਸਕਣ ਆਪਣਾ